ਹੈਲੋ ਹੈਲੋ ਯੈੱਸ ਮੈਮ ਗੁਡ ਆਫਟਰਨੂਨ ਮੈਮ ਯੈੱਸ ਮੈਮ ਓਕੇ ਮੈਮ ਅਤੇ ਮੈਮ ਆਪਣਾ ਰੂਮ ਨੰਬਰ ਦੱਸਿਓ ਐਸ ਟੂ ਜ਼ਿਰੋ ਟੂ ਅਤੇ ਮੈਮ ਤੁਸੀਂ ਚੈਕ ਇਨ ਕਦੋਂ ਕੀਤਾ ਸੀ ਅੱਛਾ ਮੈਮ ਅਤੇ ਇਹ ਆਵਾਜ਼ ਕਿਸ ਤਰ੍ਹਾਂ ਦੀ ਸੀਗੀ ਥੋੜ੍ਹਾ ਡਿਸਕਰਾਈਬ ਕਰ ਸਕਦੇ ਓ ਓਕੇ ਓਕੇ ਮੈਮ ਅਤੇ ਹੋਰ ਕੋਈ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਓ ਓਕੇ ਮੈਮ ਅਤੇ ਹੋਰ ਮੈਮ ਕੋਈ ਸਰਵਿਸ ਚਾਹੀਦੀ ਹੋਵੇ ਲਾਈਕ ਡਿਨਰ ਵਗੈਰਾ ਓਕੇ ਮੈਮ ਅਸੀਂ ਜਲਦੀ ਇਸ ਚੀਜ਼ ਦੇ ਉੱਤੇ ਦੇਖਦੇ ਹਾਂ ਅਤੇ ਤੁਹਾਨੂੰ ਅੱਗੇ ਤੋਂ ਕੋਈ ਇੱਦਾਂ ਦੀ ਕੰਪਲੇਂਨ ਨਹੀਂ ਆਏਗੀ ਮੈਮ ਮੈਂ ਹੁਣੇ ਹੁਣੇ ਇੱਕ ਟੀਮ ਭੇਜਦਾਂ ਤੁਹਾਡੇ ਕੋਲ ਅਤੇ ਮੈਮ ਤੁਹਾਡਾ ਇੱਕ ਵਾਰ ਆਪਣਾ ਦੁਬਾਰਾ ਮਤਲਬ ਫਲੋਰ ਦੱਸਿਓ ਅਤੇ ਰੂਮ ਨੰਬਰ ਦੱਸਿਓ ਅਤੇ ਮੈਮ ਤੁਹਾਡੀ ਚੈਕ ਇਨ ਆਈ ਡੀ ਚੈਕ ਇਨ ਆਈ ਡੀ

ਚਲੋ ਹਾਂ ਰੋਲ ਨੰਬਰ ਦੱਸ ਦਿਓ ਓਕੇ ਮੈਮ ਅਸੀਂ ਆਉਂਦੇ ਹਾਂ ਹੁਣੇ ਆਨੇ ਹਾਂ ਮੈਮ ਥੋੜ੍ਹੀ ਦੇਰ ਤੱਕ ਓਕੇ ਮੈਮ ਓਕੇ ਬਾਏ